ਪੰਜਾਬ ਅੱਜ ਦੇ ਸਮੇਂ ਵਿੱਚ ਬਹੁਤ ਤਰੱਕੀ ਕਰ ਚੁੱਕਾ ਹੈ ਅਤੇ ਇਸ ਵਿੱਚ ਕਈ ਤਰ੍ਹਾਂ ਦੀਆਂ ਥਾਵਾਂ ਹਨ ਜਿੱਥੇ ਹਰ ਸਾਲ ਸੈਲਾਨੀ ਘੁੰਮਣ ਆਉਂਦੇ ਹਨ ਹੁਣ ਹੁਣ ਪੰਜਾਬ ਦੇ ਲੋਕ ਕਈ ਤਰ੍ਹਾਂ ਦੀਆਂ ਪੰਜਾਬ ਵਿੱਚ ਸਥਾਨਕ ਗਾਈਡ ਟੂਰਿਸਟ ਅਵੇਲੇਬਲ ਹਨ ਜਿਨ੍ਹਾਂ ਵਿੱਚੋਂ ਸਭ ਤੋਂ ਗੱਲ ਵੱਧ ਗੱਲ ਕਰੀਏ ਤਾਂ ਓਲਾ ਕੈਬ ਊਬਰ ਟੈਕਸੀਆਂ ਵੀ ਅਵੇਲੇਬਲ ਹਨ ਅਤੇ ਪੰਜਾਬ ਵਿੱਚ ਕਈ ਤਰ੍ਹਾਂ ਦੇ ਹੋਟਲ ਅਤੇ ਗਾਈਡੈ ਸੈਲਾਨੀ ਹੈ ਹੈਲਪਲਾਈਨ ਆਦਿ ਅਵੇਲੇਬਲ ਹਨ ਜੋ ਕਿ ਪੰਜਾਬ ਵੱਖਰੀ ਵੱਖਰੀ ਤਰ੍ਹਾਂ ਦੀਆਂ ਭਾਸ਼ਾ ਬੋਲ ਸਕਦੇ ਹਨ ਜਿਵੇਂ ਹਿੰਦੀ ਇੰਗਲਿਸ਼ ਅਤੇ ਪੰਜਾਬੀ ਇਸ ਇਸ ਤਰ੍ਹਾਂ ਪੰਜਾਬ ਵਿੱਚ ਕਈ ਤਰ੍ਹਾਂ ਦੇ ਗਾਈਡ ਹਨ ਜੋ ਕਿ ਸਸਤੇ ਤੌਰ 'ਤੇ ਸੈਲਾਨੀਆਂ ਲਈ ਅਵੇਲੇਬਲ ਹੁੰਦੇ ਹਨ ਜੋ ਕਿ ਕਈ ਤਰ੍ਹਾਂ ਦੀਆਂ ਸਥਾਨਕ ਭਾਸ਼ਾਵਾਂ ਤੋਂ ਇਲਾਵਾ ਪੰਜਾਬ ਦੀਆਂ ਹੋਰ ਭਾਸ਼ਾਵਾਂ ਅਤੇ ਖੇਤਰੀ ਭਾਸ਼ਾਵਾਂ ਵਿੱਚ ਗੱਲ ਕਰੀਏ ਤਾਂ ਹਿੰਦੀ ਭਾਸ਼ਾਵਾਂ ਵਿੱਚ ਬੋਲ ਸਕਦੇ ਹਨ ਅ ਅਤੇ ਇਸ ਤੋਂ ਇਲਾਵਾ ਕਈ ਟੂਰਿਸਟ ਅੰਗਰੇਜ਼ੀ ਭਾਸ਼ਾ ਵਿੱਚ ਵੀ ਬੋਲ ਕੇ ਟਰਾਂਸਲੇਟ ਕਰ ਸਕਦੇ ਹਨ ਇਸ ਤਰ੍ਹਾਂ ਇਹ ਸੈਲਾਨੀਆਂ ਲਈ ਖਿੱਚ ਦਾ ਕਾਰਨ ਬਣਦੇ ਹਨ